ਮੇਰੇ ਪਰਿਵਾਰ ਵਿੱਚ ਮੇਰੀ ਮਾਂ ਦਾ ਬਹੁਤ ਵੱਡਾ ਯੋਗਦਾਨ ਹੈ ਖਾਣੇ ਦੇ ਇਸ ਵਿੱਚ ਅਤੇ ਛੋਟੇ ਹੁੰਦੇ ਤੋਂ ਅਸੀਂ ਆਪਣੀ ਮਾਂ ਦਾ ਖਾਣਾ ਖਾਂਦੇ ਆ ਰਹੇ ਹਾਂ ਜੋ ਕਿ ਸਾਨੂੰ ਮਾਂ ਖਾਣਾ ਹੱਥ ਦਾ ਖਾਣਾ ਬਹੁਤ ਹੀ ਜ਼ਿਆਦਾ ਟੇਸਟੀ ਲੱਗਦਾ ਹੈ ਸੁਆਦ ਲੱਗਦਾ ਹੈ ਜੋ ਕਿ ਮੇਰੇ ਨਹੀਂ ਹਰ ਇੱਕ ਪਰਿਵਾਰ ਵਿੱਚ ਐਦੀ ਹੋਣਾ ਹੁੰਦਾ ਅਤੇ ਪਰ ਮੈਂ ਆਪਣੀ ਮਾਂ ਦਾ ਖਾਣਾ ਬਹੁਤ ਵਧੀਆ ਖਾਂਦਾ ਕਿਉਂਕਿ ਬਹੁਤ ਵਧੀਆ ਬਣਾਉਂਦੀ ਹੈ ਬਹੁਤ ਰੀਝ ਨਾਲ ਬਣਾਉਂਦੀ ਹੈ ਬਹੁਤ ਪਿਆਰ ਹੁੰਦਾ ਉਸ ਖਾਣੇ ਵਿੱਚ ਅਤੇ ਮੈਨੂੰ ਬਹੁਤ ਹੀ ਮੈਂ ਇੰਨਜੋਏ ਕਰਦਾ ਇਸ ਚੀਜ਼ ਨੂੰ ਮੁਮੈਂਟ ਨੂੰ ਅਤੇ ਮੈਂ ਆਪਣੇ ਮਾਤਾ ਤੋਂ ਖਾਣਾ ਸਿੱਖਿਆ ਬਣਾਉਣਾ ਖਾਸ ਕਰਕੇ ਮੈਂ ਆਪਣੀ ਮਾਤਾ ਦੇ ਹੱਥ ਦਾ ਚਿਕਨ ਪਸੰਦ ਹੈ ਬਹੁਤ ਵਧੀਆ ਚਿਕਨ ਮਸਾਲਾ ਮੇਰੀ ਮਾਤਾ ਬਣਾਉਂਦੀ ਹੈ ਅਤੇ ਜਿੱਦਾਂ ਉਹ ਸਭ ਤੋਂ ਪਹਿਲਾਂ ਤ ਤੜਕਾ ਲਾਉਂਦੀ ਹੈ ਪਿਆਜ ਟਮਾਟਰ ਹਰੀ ਮਿਰਚ ਨੂੰ ਤੜਕਾ ਲਾ ਕੇ ਭੁੰਨ ਕੇ ਫਿਰ ਬਾਅਦ 'ਚ ਉਹਨੂੰ ਗ੍ਰੈ਼ਂਡ ਕਰਨਾ ਗ੍ਰੈਂਡ ਕਰਨ ਤੋਂ ਬਾਅਦ ਫਿਰ ਇੱਕ ਵਾਰੀ ਤੇਲ 'ਚ ਜਾਂ ਤੜਕਾ ਲਾ ਕੇ ਜ਼ੀਰਾ ਪਾ ਕੇ ਉਹਦੇ ਵਿੱਚ ਫਿਰ ਉਹ ਮਸਾਲਾ ਐਡ ਕਰਨਾ ਗਰੇਬੀ ਐਨ ਵਧੀਆ ਬਣਾ ਕੇ ਦਸ ਪੰਦਰ੍ਹਾਂ ਮਿੰਟ ਰਿਜ ਤੜ ਐਨ ਰਿਜਾ ਕੇ ਫਿਰ ਉਹਦੇ ਵਿੱਚ ਚਿਕਨ ਐਡ ਕਰਨਾ ਹੈ ਪਾਣੀ ਅਸੀਂ ਬਹੁਤ ਘੱਟ ਤੋਂ ਘੱਟ ਪਾਉਂਦੇ ਕਿਉਂਕਿ ਮਸਾਲਾ ਚਿਕਨ ਬਣਾਉਣ ਦਾ ਅਤੇ ਉਹ ਚਿਕਨ ਇੰਨਾ ਹੀ ਸੁਆਦ ਬਣਦਾ ਵੀ ਬੰਦਾ ਉਂਗਲੀਆਂ ਹੀ ਚੱਟਦਾ ਰਹਿ ਜਾਂਦਾ ਅਤੇ ਮੈਨੂੰ ਮੇਰੀ ਮਾਂ ਦਾ ਚਿਕਨ ਬਹੁਤ ਵਧੀਆ ਲੱਗਦਾ ਉਹ ਚਿਕਨ ਖਾ ਖਾ ਕੇ ਮੈਂ ਮੋਟਾ ਬਹੁਤ ਹੋ ਗਿਆ ਤੇਅਤੇ ਮੈਂ ਤਾਂ ਜਦ ਵੀ ਹੁਣ ਅੱਜ ਆਪ ਖੁਦ ਬਣਾਉਂਦਾ ਆਪਣੇ ਹੱਥੀਂ ਬਣਾਉਂਦਾ ਜਿੱਦਾਂ ਮੇਰੀ ਮਾਤਾ ਬਣਾਉਂਦੀ ਸੀ ਮੈਂ ਵੀ ਉੱਦੀ ਹੀ ਬਣਾਉਂਦਾ ਕਿਉਂਕਿ ਉਹਨਾਂ ਨੇ ਜੋ ਮੈਨੂੰ ਸਿਖਾਇਆ ਮੈਂ ਉੱਦੀ ਹੀ ਬਣਾਉਂਦਾ